ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਨਸੀ ਹੈ ਮੈਂ ਦਸ ਦਿਨ ਪਹਿਲੇ ਤੁਹਾਡੀ ਕੰਪਨੀ ਤੋਂ ਕਾਲੇ ਰੰਗ ਦੇ ਸਟੀਲੈਟੋ ਹੀਲਸ ਆਰਡਰ ਕੀਤੇ ਸਨ ਜੋ ਕਿ ਮੈਨੂੰ ਔਡਰ ਦੀ ਜਾਣਕਾਰੀ ਮੁਤਾਬਕ ਹੀ ਮੇਰੇ ਐਡਰੈਸ 'ਤੇ ਪਹੁੰਚਾਏ ਗਏ ਸਨ ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ ਪਰ ਮੈਨੂੰ ਖੇਦ ਹੈ ਕਿ ਇਹ ਕਾਲੇ ਹੀਲਸ ਮੇਰੇ ਨਾਪ ਦੇ ਨਾ ਹੋਣ ਕਾਰਨ ਕਾਫੀ ਅਸੁਵਿਧਾਜਨਕ ਹਨ

ਅਤੇ ਇਹ ਵੀ ਕਿ ਮੈਂ ਆਪਣੇ ਆਰਡਰ ਦੀ ਵਾਪਸੀ ਦੀ ਸਥਿਤੀ ਕਿਵੇਂ ਟਰੈਕ ਕਰ ਸਕਦੀ ਹਾਂ ਮੇਰੇ ਵੱਲੋਂ ਆਰਡਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਅਤੇ ਮੈਨੂੰ ਦੱਸੋ ਕਿ ਮੈਂ ਇਹਨਾਂ ਨੂੰ ਕਦ ਤੱਕ ਵਾਪਸ ਜਾਂ ਬਦਲ ਸਕਦੀ ਹਾਂ ਜੇਕਰ ਕੰਪਨੀ ਨੂੰ ਮੇਰੇ ਵੱਲੋਂ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮੈਨੂੰ ਉਸ ਦੇ ਬਾਰੇ ਵੀ ਜਲਦ ਤੋਂ ਜਲਦ ਦੱਸਿਆ ਜਾਵੇ ਧੰਨਵਾਦ